ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਕੰਪਨੀ ਤੋਂ ਇੱਕ ਫੇਸ ਕਰੀਮ ਔਡਰ ਕੀਤੀ ਜੋ ਕਿ ਬ੍ਰਾਂਡਡ ਆ ਅਤੇ ਉਹਦੀ ਐਡ ਟੀ ਵੀ 'ਤੇ ਦੇਖੀ ਐਡ ਵਿੱਚ ਤਾਂ ਇਸ ਕ੍ਰੀਮ ਬਾਰੇ ਬਹੁਤ ਹੀ ਵਧੀਆ ਦਿਖਾਇਆ ਗਿਆ ਕਿ ਇਹ ਰੰਗ ਗੋਰਾ ਕਰ ਦਿੰਦੀ ਹੈ ਅਤੇ ਇਸਦੇ ਬਹੁਤ ਫਾਇਦੇ ਨੇ ਪਰ ਜਦੋਂ ਮੈਂ ਇਹ ਕ੍ਰੀਮ ਆਪਣੇ ਮੂੰਹ 'ਤੇ ਇਸਤੇਮਾਲ ਕੀਤੀ ਤਾਂ ਮੇਰੀ ਚਮੜੀ ਗੋਰੀ ਹੋਣ ਦੀ ਬਜਾਏ ਕਾਲੀ ਹੋ ਗਈ ਅਤੇ ਮੇਰੇ ਮੂੰਹ 'ਤੇ ਕਿੱਲ ਨਿਕਲ ਆਏ ਅਤੇ ਬਹੁਤ ਜ਼ਿਆਦਾ ਖਾਰਿਸ਼ ਹੋਣੀ ਸ਼ੁਰੂ ਹੋ ਗਈ ਇਸ ਕ੍ਰੀਮ ਦੀ ਕੁਆਲਿਟੀ ਬਹੁਤ ਹੀ ਘਟੀਆ ਹੈ ਅਤੇ ਇਹ ਕ੍ਰੀਮ ਜਿਸ ਤਰ੍ਹਾਂ ਦਿਖਾਈ ਗਈ ਸੀ ਉਸ ਤੋਂ ਬਹੁਤ ਉਲਟ ਇਹਦਾ ਨਤੀਜਾ ਨਿਕਲਿਆ ਹੈ ਕ੍ਰੀਮ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਖਰਾਬ ਹੈ ਜਿਸ ਕਰਕੇ ਮੇਰਾ ਮੂੰਹ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਹੁਣ ਇਸ ਦਾ ਹਰਜਾਨਾ ਤੁਹਾਨੂੰ ਹੀ ਭਰਨਾ ਪੈਣਾ ਹੈ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਧੰਨਵਾਦ